ਜਦੋਂ ਇੱਕ ਨਵਜੰਮਾ ਬੱਚਾ ਜਨਮਦਾ ਹੈ ਤਾਂ ਉਹਦੇ ਲਈ ਵੱਖ ਵੱਖ ਤਰ੍ਹਾਂ ਦੇ ਰਸਮਾਂ ਕੀਤੀਆਂ ਜਾਂਦੀਆਂ ਹਨ ਹੁਣ ਸਵਾਲ ਇਹ ਹੈ ਕਿ ਉਹ ਕਿਸ ਧਰਮ ਤੋਂ ਹੈ ਹਰ ਧਰਮ ਦੀ ਆਪਣੀ ਆਪਣੀ ਵਿਆਖਿਆ ਹੈ ਆਪਣੇ ਆਪਣਾ ਸੰਬੰਧ ਹੈ ਬਹੁਤ ਸਾਰੀ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਨਾਮਕਰਨ ਹੋ ਗਿਆ ਜਠੇਰਿਆਂ ਦੇ ਜਾਣਾ ਹੋ ਗਿਆ ਮੁੰਡਨ ਹੋ ਗਿਆ ਚੌਲਾ ਪਾਉਣਾ ਹੋ ਗਿਆ ਆਦਿ ਸਭ ਤੋਂ ਪਹਿਲਾਂ ਬੱਚੇ ਦੇ ਚੌਲਾ ਪਾਇਆ ਜਾਂਦਾ ਹੈ ਇਹ ਰਸਮ ਜਦੋਂ ਇੱਕ ਨਵਾਂ ਬੱਚਾ ਜਨਮਦਾ ਹੈ ਉਸ ਤੋਂ ਤੇਰ੍ਹਾਂ ਦਿਨਾਂ ਬਾਅਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਬੱਚੇ ਨੂੰ ਗੁੜਤੀ ਖਵਾਈ ਜਾਂਦੀ ਹੈ ਕਹਿਣ ਦਾ ਭਾਵ ਹੈ ਕਿ ਉਸਨੂੰ ਸ਼ਹਿਦ ਚਟਾਇਆ ਜਾਂਦਾ ਹੈ ਮਨ ਮਾਨਤਾ ਇਹ ਹੈ ਕਿ ਇਹ ਘਰ ਦਾ ਸਭ ਤੋਂ ਸਿਆਣਾ ਬੰਦਾ ਹੀ ਦਿੰਦਾ ਹੈ ਇਹ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਉਸ ਦੇ ਗੁਣ ਉਸ ਨਵਜੰਮੇ ਬੱਚੇ ਵਿੱਚ ਆ ਜਾਣ ਉਸ ਤੋਂ ਬਾਅਦ ਨਵਜੰਮੇ ਬੱਚੇ ਦਾ ਨਾਮਕਰਨ ਕੀਤਾ ਜਾਂਦਾ ਹੈ ਜੋ ਕਿ ਘਰਦਿਆਂ ਦੀ ਸਹਿਮਤੀ ਨਾਲ ਇੱਕ ਅੱਖਰ ਰੱਖਿਆ ਜਾਂਦਾ ਇੱਕ ਅੱਖਰ ਤੋਂ ਨਾਮ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਜਠੇਰਿਆਂ ਦੇ ਜਾਇਆ ਜਾਂਦਾ ਹੈ ਮਾਨਤਾ ਹੈ ਕਿ ਜਦ ਇੱਕ ਨਵਜੰਮਾ ਬੱਚਾ ਜਨਮਦਾ ਹੈ ਤਾਂ ਉਸ ਦੇ ਪੂਰਵਜਾਂ ਲਈ ਉਸ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਇਸ ਲਈ ਉਹਨੂੰ ਵੱਖ ਵੱਖ ਜਠੇਰਿਆਂ ਦੇ ਜਾਂ ਵੱਖ ਵੱਖ ਮੰਦਰਾਂ ਮਸਜਿਦਾਂ ਵਿੱਚ ਲੈ ਕੇ ਜਾਇਆ ਜਾਂਦਾ ਹੈ ਉਸ ਤੋਂ ਬਾਅਦ ਬੱਚੇ ਦੇ ਮੁੰਡਨ ਕੀਤੇ ਜਾਂਦੇ ਹਨ ਮੁੰਡਨ ਤੋਂ ਭਾਵ ਹੈ ਉਸਦੇ ਬਾਲ ਕਟਾਈ ਦੀ ਰਸਮ ਕੀਤੀ ਜਾਂਦੀ ਹੈ ਇਸ ਤਰ੍ਹਾਂ ਹਰ ਇੱਕ ਰਸਮ ਦੀ ਆਪਣੀ ਆਪਣੀ ਮਾਨਤਾ ਹੈ ਆਪਣੇ ਆਪਣਾ ਇਤਿਹਾਸ ਹੈ